ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੱਸੋ ਹਾਂਜੀ ਕਈ ਜਗ੍ਹਾ ਹੈ ਆਪਣੀ ਕਿਹੜੀ ਜਗ੍ਹਾ 'ਤੇ ਜਾਣਾ ਚਾਹੁਦੇ ਹੋ ਅੰਬਰਸਰ ਸਾਹਿਬ ਅੰਮ ਅਨੰਦਪੁਰ ਸਾਹਿਬ ਹੋਰ ਵੀ ਹੈ ਕੁੱਲੂ ਮਨਾਲੀ ਸ਼ਿਮਲਾ ਕਿਉਂ ਅੰਬਰਸਰ ਸਾਹਿਬ ਆਪਣੇ ਆਹੀ ਦਰਬਾਰ ਸਾਹਿਬ ਗੁਰਦੁਆਰਾ ਉੱਥੇ ਜਲ੍ਹਿਆਂ ਵਾਲਾ ਬਾਗ ਹੈ ਬਾਘਾ ਬੋਡਰ ਹੈ ਔਰ ਪਰੇਡ ਹੁੰਦੀ ਹੈ ਫੌਜੀਆਂ ਦੀ ਬਹੁਤ ਕੁਛ ਦੇਖਣ ਨੂੰ ਉੱਥੇ ਵੀ ਹਾਂ ਰਹਿਣੇ ਅਨੰਦਪੁਰ ਸਹਿਬ ਜੀ ਵਧੀਆ ਉੱਥੇ ਵੀ ਗੁਰੂ ਦਾ ਇਤਿਹਾਸ ਉੱਥੇ ਵੀ ਗੁਰੂ ਸਿੰਘ ਦਾ ਅਜੂਬਾ ਉੱਥੇ ਬਣਿਆ ਨਵਾਂ ਹੁਣ ਅਜੂਬਾ ਹੈ ਹੋਰ ਕਈ ਐਟਮਾਂ ਉੱਥੇ ਗੁਰੂ ਘਰ ਦੇਖਣ ਵਾਲੇ ਬਹੁਤ ਵਧੀਆ ਗੁਰੂ ਜੀ ਦਾ ਅਸਥਾਨ ਉੱਥੇ ਵੀ ਘੁੰਮਣ ਫਿਰਨ ਨੂੰ ਬਹੁਤ ਵਧੀਆ ਜਗ੍ਹਾ ਆਪਣਾ ਇਹ ਦੋਨੇ ਜਗ੍ਹਾਂ ਨੂੰ ਮਿਲਾ ਪੰਜ ਛੇ ਕੁ ਹਜ਼ਾਰ ਰੁਪਇਆ ਖਰਚਾ ਆ ਜਾਣਾ ਹਾਂਜੀ ਤੇਲ ਆਪਣਾ ਉਹੀ ਤਿੰਨ ਕੁ ਹਜ਼ਾਰ ਰੁਪਈਏ ਦਾ ਹਾਂ ਸਾਰਾ ਕੁਛ ਸਾਡਾ ਹੋਵੇਗਾ ਰੋਟੀ ਪਾਣੀ ਵੀ ਸਾਡਾ ਹਾਂ ਹਾਂ ਹਾਂ ਰਹਿਣ ਨਾ ਰਹਿਣ ਸਹਿਣ ਦਾ ਤੁਹਾਡਾ ਹੋਊ ਹਾਂ ਓਕੇ